ਸਾਡੇ ਪੰਜਾਬ ਦੇ ਖੇਤਰ ਦੇ ਜਾਂ ਇਸ ਖੇਤਰ ਦੇ ਬਹੁਤ ਸਾਰੇ ਲੋਕ ਗੀਤ ਨੇ ਜਿਨ੍ਹਾਂ ਦੇ ਵਿੱਚੋਂ ਵਾਰਾਂ ਨੇ ਵਾਰਾਂ ਵੀ ਸਾਡੇ ਲੋਕ ਗੀਤ ਦੀਆਂ ਹੀ ਇੱਕ ਕਿਸਮ ਆ ਜਿਹੜੀਆਂ ਸੂਰਬੀਰ ਯੋਧਿਆਂ ਦੀ ਸਿਫਤ ਦੇ ਵਿੱਚ ਗਾਈਆਂ ਜਾਂਦੀਆਂ ਨੇ ਵਾਰਾਂ ਨੂੰ ਬਾਅਦ ਵਿੱਚ ਆਧਿਆਤਮਿਕ ਰੰਗ ਚਾੜ੍ਹਦੇ ਹਾਂ ਗੁਰਬਾਣੀ ਦੇ ਵਿੱਚ ਵੀ ਅਧਿਆਤਮਿਕ ਵਾਰਾਂ ਦਰਜ ਕੀਤੀਆਂ ਗਈਆਂ ਜਿਹਦੇ ਵਿੱਚ ਕਿਸੇ ਮਨੁੱਖ ਦੀ ਸਿਫਤ ਨਹੀਂ ਬਲਕਿ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਗਈ ਆ ਇਸ ਤਰੀਕੇ ਦੇ ਨਾਲ ਮਿਰਜ਼ਾ ਹੀਰ ਇਹ ਸਾਰੇ ਲੋਕ ਗੀਤ ਪੰਜਾਬ ਦੀ ਧਰਤੀ ਦੇ ਬੜੇ ਪ੍ਰਸਿੱਧ ਲੋਕ ਗੀਤ ਨੇ ਸੁੱਚੇ ਸੂਰਮੇ ਦੇ ਨਾਲ ਸੰਬੰਧਿਤ ਇੱਕ ਲੋਕ ਗੀਤ ਪ੍ਰਚਲਿਤ ਆ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕ ਗੀਤ ਜਿਹੜੇ ਪੰਜਾਬ ਦੀ ਧਰਤੀ ਦੇ ਵਿੱਚ ਪਰ ਉਹਨਾਂ ਦਾ ਵਿਸ਼ਾ ਸੂਰਬੀਰਤਾ ਨੂੰ ਜ਼ਾਹਰ ਕਰਦਾ ਜਿਹੜੇ ਪੰਜਾਬ ਦੇ ਨੌਜਵਾਨਾਂ ਦੀ ਸੂਰਬੀਰਤਾ ਜਾਂ ਪੰਜਾਬ ਦੇ ਗੱਭਰੂ ਕਿਵੇਂ ਦੁੱਖਾਂ ਮੁਸੀਬਤਾਂ ਦੇ ਨਾਲ ਟੱਕਰ ਲੈਂਦੇ ਰਹੇ ਨੇ ਕਿਵੇਂ ਹਮਲਾਵਰਾਂ ਦੇ ਨਾਲ ਟੱਕਰ ਲੈਂਦੇ ਰਹੇ ਨੇ ਹੱਕ ਸੱਚ ਲਈ ਧਰਮ ਲਈ ਪੰਥ ਲਈ ਆਪਣੀਆਂ ਜਾਨਾਂ ਨੂੰ ਕੁਰਬਾਨ ਕਰਦੇ ਰਹੇ ਨੇ ਉਹਨਾਂ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਗੀਤ ਜੁੜ ਗਏ ਬਣ ਗਏ ਲੋਕ ਗੀਤਾਂ ਦਾ ਭਾਵ ਹੁੰਦਾ ਲੋਕਾਂ ਦੀ ਮਾਨਸਿਕਤਾ ਦੇ ਵਿੱਚੋਂ ਆਪ ਮੁਹਾਰੇ ਜਿਹੜੇ ਸ਼ਬਦ ਅਲਫਾਜ਼ ਪ੍ਰਗਟ ਹੁੰਦੇ ਨੇ ਜਿਹੜੇ ਧੁਨਾਂ ਦੇ ਵਿੱਚ ਗੀਤ ਰੂਪਾਂ ਦੇ ਵਿੱਚ ਗਾਏ ਜਾਂਦੇ ਨੇ ਉਹਨਾਂ ਨੂੰ ਲੋਕ ਗੀਤ ਕਿਹਾ ਜਾਂਦਾ ਇਸ ਖਿੱਤੇ ਦੇ ਲੋਕਾਂ ਦੇ ਜਿਹੜੇ ਗੀਤ ਨੇ ਜਿਹੜੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਵਸੇ ਹੋਏ ਨੇ ਬਹੁਤ ਸਾਰੇ ਨੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕੀਤੀ ਆ